ਹੈਲੋ ਹਾਂਜੀ ਹਾਂਜੀ ਹਾਂਜੀ ਬੋਲੋ ਮੈਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਤੁਸੀਂ ਉਥੇ ਸੀਟ ਤੇ ਅਰਾਮਦਾਇਕ ਨੀ ਫੀਲ ਕਰ ਪਾ ਰਹੇ ਹਾਂਜੀ ਮੈਮ ਮੈਂ ਨਾ ਦੇਖਦੀ ਆਂ ਲਿਸਟ ਜੇ ਤੁਸੀਂ ਸੀਟ ਆਪਣਾ ਕੋਈ ਪੈਸੈਂਜਰ ਐਪਸੈਂਟ ਐ ਤੇ ਕੋਈ ਨਹੀਂ ਆ ਰਿਹਾ ਤੇ ਮੈਂ ਉਹ ਤੁਹਾਨੂੰ ਸੀਟ ਉਥੋਂ ਵੀ ਦੇ ਸਕਦੀ ਆ ਤੇ ਮੈਮ ਮੈਂ ਤਾਂ ਲਿਸਟ ਵਿਚ ਦੁਬਾਰਾ ਚੈੱਕ ਕਰ ਲੈਦੀ ਆ ਤੇ ਫਿਰ ਤੁਹਾਨੂੰ ਵਿੰਡੋ ਵਾਲੀ ਸੀਟ ਦੇ ਸਕਾਂਗੇ ਅਸੀਂ ਤੇ ਤੁਹਾਡੀਆਂ ਸੇਵਾਵਾਂ ਸਾਨੂੰ ਤੁਹਾਨੂੰ ਸੇਵਾਵਾਂ ਵਿੱਚ ਕੋਈ ਪਰੇਸ਼ਾਨੀ ਨਹੀਂ ਆਏਗੀ ਤੇ ਤੁਸੀਂ ਆਰਾਮਦਾਇਕ ਆਪਦਾ ਸਫਰ ਤੈਅ ਕਰ ਸਕੋਗੇ ਹਾਂਜੀ ਹਾਂਜੀ ਹਾਂਜੀ ਮੈ ਲਿਸਟ ਚੈਕ ਕਰਨੀ ਆ ਕੋਈ ਪੈਸੰਜਰ ਜੇ ਕੋਈ ਨਹੀਂ ਆ ਰਿਹਾ ਤਾਂ ਮੈਂ ਉਹ ਵਾਲੀ ਸੀਟ ਤੁਹਾਨੂੰ ਦੇ ਦਿਨੀ ਆ ਇੱਕ ਵਾਰ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਆ ਤੁਹਾਡੀ ਸਮੱਸਿਆਵਾਂ ਨੂੰ ਹੁਣੇ ਮੈਂ ਹੈਲਪ ਕਰਦੀ ਆਂ ਤੇ ਹੋਰ ਕੋਈ ਤੁਹਾਨੂੰ ਸਮੱਸਿਆ ਹੋਵੇ ਹਾਂਜੀ ਹਾਂਜੀ ਫਿਰ ਮੈਂ ਤੁਹਾਨੂੰ ਨਾ ਵਿਚਕਾਰ ਵਾਲੀਆਂ ਸੀਟਾਂ ਜਿਹਲੀਆਂ ਹੁੰਦੀਆਂ ਨੇ ਨਾ ਤੁਸੀਂ ਇਹ ਦੱਸੋ ਤੁਸੀਂ ਤਿੰਨ ਸੀਟਿਡ ਵਾਲੀ ਸਾਈਡ ਬੈਠਣਾ ਪਸੰਦ ਕਰੋਗੇ ਜਾਂ ਦੋ ਸਿਟਿਡ ਆਲੀ ਸਾਈਡ ਤੇ ਫਿਰ ਮੈਂ ਤੁਹਾਨੂੰ ਵਿਚ ਵਾਲੀਆਂ ਸੀਟਾਂ ਦੇ ਦਿੰਦੀ ਆ ਤੇ ਵੇਖਦੀ ਆ ਜੇ ਉਥੇ ਹੋਈਆਂ ਤਾਂ ਠੀਕ ਹ ਨਹੀਂ ਤਾਂ ਅੱਗੇ ਫਿਰ ਜਿਹੜੀਆਂ ਫਰੰਟ ਤੇ ਹੁੰਦੀਆਂ ਨੇ ਤੇ ਉਹ ਵਾਲੀਆਂ ਸੀਟਾਂ ਜੇ ਤੁਹਾਨੂੰ ਦੇ ਦਿੱਤੀਆਂ ਜਾਣ ਤਾਂ ਤੁਹਾਨੂੰ ਕੋਈ ਇਤਰਾਜ ਤਾਂ ਨਹੀਂ ਹੋਏਗਾ ਹਾਂਜੀ ਹਾਂਜੀ ਸਾਡੀ ਬਸ ਪੂਰੀ ਨਵੀਂ ਹੈ ਤੇ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਏਗੀ ਹਾਂਜੀ